ਪਟਿਆਲਾ ਸ਼ਹਿਰ 'ਚ ਹਰ ਧਰਮ ਹਰ ਜਾਤ ਪਾਤ ਵੱਖ ਵੱਖ ਧਰਮਾਂ ਉਹ ਨਾਲ਼ ਸੰਬੰਧਿਤ ਲੋਕ ਰਹਿੰਦੇ ਨੇ ਹਰ ਧਰਮ ਦੇ ਹੀ ਲੋਕ ਰਹਿੰਦੇ ਨੇ ਅਤੇ ਸਾਡੇ ਆਲੇ ਦੁਆਲੇ ਵੀ ਹਰ ਧਰਮ ਦੇ ਲੋਕ ਮਿਲਦੇ ਨੇ ਹਿੰਦੂ ਭਾਈਚਾਰਾ ਵੀ ਆ ਮੁਸਲਿਮ ਵੀ ਨੇ ਸਿੱਖ ਭਾਈਚਾਰਾ ਈਸਾਈ ਭਾਈਚਾਰਾ ਵੀ ਆ ਹਰ ਧਰਮ ਦੇ ਮਤਲਬ ਭਾਈਚਾਰਾ ਰਹਿੰਦਾ ਅਤੇ ਕਿਸੇ ਧਰਮ ਵਿੱਚ ਮੀਟ ਖਾਣਾ ਸਹੀ ਆ ਕਿਸੇ ਧਰਮ 'ਚ ਮੀਟ ਖਾਣਾ ਗਲਤ ਆ ਅਤੇ ਕ ਕਿਸੇ ਧਰਮ 'ਚ ਸੁੱਖ ਦੇਣਾ ਸਹੀ ਆ ਗਲਤ ਆ ਕਿਸੇ ਧਰਮ 'ਚ ਝਟਕਾਉਣਾ ਸਹੀ ਆ ਕਿਸੇ 'ਚ ਗਲਤ ਮੰਨਿਆ ਜਾਂਦਾ ਅਤੇ ਹਰ ਧਰਮ ਦੇ ਆਪੋ ਆਪਣੇ ਹੈ ਨਾ ਰੀਤੀ ਰਿਵਾਜ਼ ਨੇ ਵੱਖ ਵੱਖ ਚੀਜ਼ਾਂ ਰੀਤੀ ਰਿਵਾਜ਼ਾਂ ਅਨੁਸਾਰ ਚੱਲਦਾ ਧਰਮ ਅਤੇ ਹੁਣ ਕਈ ਧਰਮਾਂ 'ਚ ਝਟਕਾਉਣਾ ਸਹੀ ਮੰਨਿਆ ਜਾਂਦਾ ਕਈਆਂ 'ਚ ਗਲਤ ਮੰਨਿਆ ਜਾਂਦਾ ਕਈਆਂ 'ਚ ਨੋਨ ਵੈੱਜ਼ ਨੂੰ ਪਾਪ ਮੰਨਦੇ ਨੇ ਖਾਣਾ ਅਤੇ ਕਈਆਂ 'ਚ ਨਹੀਂ ਪਾਪ ਮੰਨਦੇ ਵੀ ਉਹ ਕਹਿੰਦੇ ਨਹੀਂ ਨੋਰਮਲ ਆ ਖਾਣਾ ਚਾਹੀਦਾ ਅਤੇ ਹਰ ਧਰਮ ਦਾ ਆਪੋ ਆਪਣੇ ਰੀਤੀ ਰਿਵਾਜ਼ ਨੇ ਤਰੀਕੇ ਨੇ ਤੌਰ ਢੰਗ ਨੇ ਹਰ ਚੀਜ਼ ਦੀ ਵਜ੍ਹਾ ਹਰ ਧਰਮ 'ਚ ਅਲੱਗ ਅਲੱਗ ਹੈ ਨਾ ਆਪਣਾ ਆਪਣਾ ਅਲੱਗ ਅਲੱਗ ਤੌਰ ਤਰੀਕੇ ਨਾਲ਼ ਹਰ ਧਰਮ ਦੇ ਰੀਤੀ ਰਿਵਾਜ਼ ਚੱਲਦੇ ਰਹਿੰਦੇ ਨੇ